ਸਤਿ ਸ਼੍ਰੀ ਅਕਾਲ ਜੀ ਪੈਟਰੋਲ ਦੀਆਂ ਵੱਧਦੀਆਂ ਜਿਹੜੀ ਕੀਮਤ ਹੈ ਉਹ ਤਾਂ ਜੀ ਇਹ ਗੱਲ ਹੈਗੀ ਇਕੱਲੇ ਮੈਨੂੰ ਹੀ ਨਹੀਂ ਮੈਂ ਮੇਰਾ ਇਹ ਮੰਨਣਾ ਵੀ ਜਿੰਨੇ ਵੀ ਬੰਦੇ ਬਾਈਕ ਯੂਜ ਕਰਦੇ ਆ ਪਰਸਨਲੀ ਸਾਰਿਆਂ ਨੂੰ ਹੀ ਪ੍ਰਭਾਵਿਤ ਕੀਤਾ ਜੀ ਕਿਉਂਕਿ ਜਿਵੇਂ ਜਿਵੇਂ ਕੀਮਤਾਂ ਵੱਧਦੀਆਂ ਗਈਆਂ ਨੇ ਅਤੇ ਪੈਟੋ ਬਾਈਕ ਦੀ ਐਵਰੇਜ ਹੈ ਉਹ ਘੱਟ ਗਈਆਂ ਨੇ ਉਹਦੇ ਬਾਅਦ ਬਾਈਕ ਨੂੰ ਬਾਹਰ ਲੈ ਕੇ ਨਿਕਲਣਾ ਥੋੜ੍ਹਾ ਔਖਾ ਹੋ ਗਿਆ ਇੱਕ ਮਿਡਲ ਕਲਾਸ ਬੰਦੇ ਦੇ ਲਈ ਇੰਨੀਆਂ ਸੈਲਰੀਆਂ ਹੁੰਦੀ ਨਹੀਂ ਜੀ ਸਾਡੀ ਅਤੇ ਬਾਈਕ ਨੂੰ ਲੈ ਕੇ ਚਲਾਉਣਾ ਪੂਰੇ ਦਿਨ ਅਤੇ ਪੈਟਰੋਲ ਇੰਨਾ ਉਹ ਖਾ ਜਾਂਦਾ ਕਿ ਬੰਦਾ ਉਹ ਬਾਈਕ ਜੋਗਾ ਹੀ ਰਹਿ ਜਾਂਦਾ ਅਤੇ ਦੂਜੀ ਗੱਲ ਇਹ ਹੋ ਗਈ ਵੀ ਜਿੰਨਾ ਜ਼ਿਆਦਾ ਆਪਾਂ ਇਹ ਮਸ਼ੀਨਾਂ ਯੂਜ ਕਰਾਂਗੇ ਓਨਾ ਹੀ ਵਾਤਾਵਰਨ ਨੂੰ ਜਿਹੜੇ ਪੇੜ ਪੌਦੇ ਆ ਜਾਂ ਆਪਾਂ ਕਹੀਏ ਵੀ ਆਪਣਾ ਐਟਮੋਸਫੀਅਰ ਹੈ ਉਹਨੂੰ ਵੀ ਨੁਕਸਾਨ ਹੁੰਦਾ ਹੀ ਹੈ ਅਤੇ ਉਹ ਚੀਜ਼ ਵੀ ਆਪਾਂ ਅਵੋਈਡ ਕਰ ਸਕਦੇ ਹਾਂ ਵੀ ਬਾਈਕ ਨੂੰ ਜਿੰਨਾ ਲੋੜ ਹੋਵੇ ਜਿੰਨਾ ਜ਼ਿਆਦਾ ਜ਼ਰੂਰੀ ਲੱਗੇ ਆਪਾਂ ਨੂੰ ਵੀ ਹੁਣ ਤਾਂ ਸਰਦਾ ਹੀ ਨਹੀਂ ਉਦੋਂ ਹੀ ਬਾਈਕ ਨੂੰ ਆਪਾਂ ਯੂਜ ਕਰਨਾ ਚਾਹੀਦਾ ਬਾਹਰ ਕੱਢਣੀ ਚਾਹੀਦੀ ਅਦਰਵਾਈਜ਼ ਪੈਦਲ ਜਾ ਕੇ ਜਾਂ ਸਾਈਕਲ 'ਤੇ ਵ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਪਾਂ ਉਹ ਆਪਣਾ ਕੰਮ ਹੈ ਉਹਨੂੰ ਨਿਬੇੜੀਏ ਧੰਨਵਾਦ